ਭਾਰਤੀ ਸਮਾਜ ਵਿੱਚ ਧਰਮ ਮਹੱਤਵਪੂਰਨ ਪੱਖਾਂ ਵਿੱਚੋਂ ਇੱਕ ਹੈ ਅਤੇ ਇੱਥੇ ਬਹੁਤ ਹੀ ਧਰਮ ਦੇ ਲੋਕ ਰਹਿੰਦੇ ਹਨ ਅਤੇ ਹਰ ਇੱਕ ਬੰਦਾ ਦੂਜੇ ਧਰਮ ਦਾ ਬਹੁਤ ਹੀ ਸਤਿਕਾਰ ਕਰਦਾ ਹੈ ਇੱਥੇ ਸਿੱਖ ਮੁਸਲਿਮ ਹਿੰਦੂ ਕ੍ਰਿਸ਼ਚਨ ਅਤੇ ਜੈਨ ਧਰਮ ਦੇ ਲੋਕ ਰਹਿੰਦੇ ਹਨ ਅਤੇ ਸਾਰੇ ਲੋਕਾਂ ਦੇ ਵਿੱਚ ਏਕਤਾ ਹੈ ਅਤੇ ਉਹ ਦੂਜੇ ਧਰਮ ਦੇ ਲੋਕਾਂ ਦੀ ਲੋਕਾਂ ਦੇ ਧਰਮ ਦੀ ਮਾਨਤਾ ਨੂੰ ਵੀ ਬਹੁਤ ਚੰਗੀ ਤਰ੍ਹਾਂ ਸਮਝਦੇ ਹਨ ਮੈਂ ਦੂਜੇ ਧਰਮਾਂ ਦੇ ਲੋਕਾਂ ਦੀ ਲੋਕਾਂ ਬਾਰੇ ਬਹੁਤ ਚੀਜ਼ਾਂ ਨੂੰ ਪਸੰਦ ਕਰਦਾ ਹਾਂ ਜਿਵੇਂ ਕਿ ਲੋਕਾਂ ਦੀ ਪਰਮਾਤਮਾ ਪ੍ਰਤੀ ਸ਼ਰਧਾ ਇੱਕ ਹੈ ਅਤੇ ਉਹ ਅਤੇ ਮੈਂ ਬਹੁਤ ਵਾਰ ਦੇਖਿਆ ਹੈ ਕਿ ਸਿੱਖਾਂ ਦੇ ਗੁਰਦੁਆਰਿਆਂ ਵਿੱਚ ਹਰ ਇੱਕ ਧਰਮ ਦਾ ਬੰਦਾ ਬਹੁਤ ਹੀ ਪਿਆਰ ਨਾਲ ਪੇਸ਼ ਆਉਂਦਾ ਹੈ ਅਤੇ ਧਰਮ ਦੀ ਏਕਤਾ ਨੂੰ ਬਣਾਈ ਰੱਖਣ ਵਜੋਂ ਇੱਕ ਨਾਗਰਿਕ ਨੂੰ ਹਰੇਕ ਧਰਮ ਦੇ ਲੋਕਾਂ ਨਾਲ ਪਿਆਰ ਅਤੇ ਸਤਿਕਾਰ ਕਰਨਾ ਚਾਹੀਦਾ ਹੈ